ਕਦੇ ਵੀ ਵਿਦਿਆਰਥੀ ਦਾ ਕਰਜ਼ ਨਹੀਂ ਲਿਆ ਹਾਲਾਂਕਿ ਇਹ ਬਹੁਤ ਜ਼ਰੂਰੀ ਹੈ ਇਹ ਖਾਸਕਰ ਪੇਂਡੂ ਸ਼ੇਤਰਾਂ ਵਿੱਚ ਜ਼ਰੂਰੀ ਹੈ ਕਿਉਂਕਿ ਪਿੰਡਾਂ ਵਿੱਚ ਟੈਲੈਂਟ ਬਹੁਤ ਜ਼ਿਆਦਾ ਹੁੰਦਾ ਹੈ ਪਰ ਪੈਸੇ ਦੀ ਮਾਰ ਕਰਕੇ ਉਹ ਟੈਲੈਂਟਡ ਬੱਚੇ ਪੜ੍ਹ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਆਪਦੀ ਰੋਜ਼ੀ ਰੋਟੀ ਦੀ ਫਿਕਰ ਟਾਈਮ ਤੋਂ ਪਹਿਲਾਂ ਹੀ ਪੈ ਜਾਂਦੀ ਹੈ ਇਹੋ ਜਿਹੇ ਵਿਦਿਆਰਥੀਆਂ ਨੂੰ ਲੱਭ ਕੇ ਕਰਜ਼ ਦੇਣਾ ਚਾਹੀਦਾ ਹੈ ਅਤੇ ਕਰਜ਼ ਦੀ ਵਿਆਜ ਵੀ ਬਹੁਤ ਘੱਟ ਹੋਣੀ ਚਾਹੀਦੀ ਹੈ ਇਸਦੇ ਨਾਲ ਨਾਲ ਹੀ ਇਹ ਜਿਹੜੀਆਂ ਫਾਰਮੈਲਟੀਜ ਨੇ ਲੋਨ ਦੀਆਂ ਸਟੂਡੈਂਟ ਲੋਨ ਦੀਆਂ ਉਹ ਬਹੁਤ ਹੀ ਘੱਟ ਹੋਣੀਆਂ ਚਾਹੀਦੀਆਂ ਨੇ ਅਤੇ ਲੋਨ ਦੀ ਰਿਕਵਰੀ ਲੋਨ ਦਾ ਇੰਟਰਸਟ ਵੀ ਬਹੁਤ ਘੱਟ ਹੋਣਾ ਚਾਹੀ ਚਾਹੀਦਾ ਹੈ ਰਿਕਵਰੀ ਜਿਹੜੀ ਹੈ ਉਸ ਬੱਚੇ ਦੀ ਨੌਕਰੀ ਲੱਗਣ ਤੋਂ ਬਾਅਦ ਜਾਂ ਉਹ ਜਿਸ ਫੀਲਡ ਵਿੱਚ ਕੰਮ ਕਰਨਾ ਚਾਹੁੰਦਾ ਦਸਤਕਾਰੀ ਹੱਥੀਂ ਆਪਦਾ ਕੰਮ ਕਰਨਾ ਚਾਹੁੰਦਾ ਉੱਥੋਂ ਅਸਟੈਬਿਸ਼ ਹੋਣ ਤੋਂ ਬਾਅਦ ਸ਼ੁਰੂ ਕੀਤੀ ਜਾਵੇ ਜਿਸਦਾ ਵਕਫਾ ਪੰਦਰ੍ਹਾਂ ਤੋਂ ਵੀਹ ਸਾਲ ਰੱਖਿਆ ਜਾ ਸਕਦਾ ਹੈ ਧੰਨਵਾਦ